ਬਹੁ ਪੇਂਡੂ ਭਾਈਚਾਰਿਆਂ ਵਿੱਚ ਖੇਤੀਬਾੜੀ ਸੱਭ ਤੋਂ ਵੱਡੀ ਸਮੱਸਿਆ ਜਿਹੜੀ ਸਾਡੇ ਪਰਾਲੀ ਦੀ ਹੈਗੀ ਹੈ ਮਤਲਬ ਅੱਜ ਤੱਕ ਮੈਂ ਅਠਾਈ ਸਾਲਾਂ ਦਾ ਹੋ ਗਿਆ ਹੈ ਨਾ ਅੱਜ ਤੱਕ ਮੈਂ ਜਦੋਂ ਦਾ ਵੀ ਮਤਲਬ ਇਹਨਾਂ ਇੱਕ ਦੋ ਧਿਆਨ ਇਸ ਚੀਜ਼ ਨੇ ਨਾ ਮਤਲਬ ਮੈਂ ਨਹੀਂ ਦੇਖਿਆ ਤਾਂ ਉਹਦੀ ਪਰਾਲੀ ਦੀ ਸਮੱਸਿਆ ਹੱਲ ਹੋਈ ਹੋਵੇ ਕਿਸੇ ਦੀ ਵੀ ਦਿਨੋਂ ਦਿਨ ਮਤਲਬ ਸਰਕਾਰ ਇਹ ਗੱਲ ਕਹਿ ਰਹੀ ਹੈ ਪਰਾਲੀ ਨੂੰ ਅੱਗ ਨਾ ਲਗਾਓ ਕਿਸਾਨਾਂ ਕੋਲ ਇਹ ਜਿਹੜੇ ਪੇਂਡੂ ਕਿਸਾਨਾਂ ਕੋਲ ਖਾਸਾ ਟਾਇਮ ਉੱਦਾਂ ਦੀ ਕੋਈ ਮਤਲਬ ਸੋਰਸਸ ਨਹੀਂ ਹੁੰਦੇ ਉਸ ਤਰ੍ਹਾਂ ਦੇ ਕੋਈ ਉਸ ਤਰ੍ਹਾਂ ਦੀ ਸਹੂਲਤ ਨਹੀਂ ਹੈਗੀ ਜਿਸ ਕਰਕੇ ਮਤਲਬ ਉਹ ਅੱਗ ਲਗਾਉਣ ਤੋਂ ਬਿਨਾਂ ਹੋਰ ਕੋਈ ਸਲਿਊਸ਼ਨ ਉਸ ਦਾ ਕਰ ਸਕਣ

ਮਤਲਬ ਸਭ ਤੋਂ ਵੱਡੀ ਸਮੱਸਿਆ ਹੈ ਸਾਡੇ ਪੰਜਾਬ 'ਚ ਕਹਿ ਲਓ ਪਰਾਲੀ ਦੀ ਕਿਉਂਕਿ ਉਹ ਪਰਾਲੀ ਨੂੰ ਉਹਨਾਂ ਨੂੰ ਯੂਟੀਲਾਇਜ ਕਰਨਾ ਹੀ ਨਹੀਂ ਆਉਂਦਾ ਯੂਟੀਲਾਇਜ ਕਰਨਾ ਹੀ ਨਹੀਂ ਆਉਂਦਾ ਕਿਉਂ ਸਿਰਫ਼ ਕਿਉਂਕਿ ਉਹਨਾਂ ਕੋਲ ਮਤਲਬ ਉਹ ਗਰੀਬ ਕਿਸਾਨ ਹੈਗੇ ਸਾਡੇ ਪਿੰਡਾਂ ਵਾਲੇ ਹੈ ਨਾ ਅਤੇ ਪਿੰਡਾਂ ਵਾਲੇ ਗਰੀਬ ਕਿਸਾਨ ਹੈਗੇ ਹੈ ਅਤੇ ਉਹਨਾਂ ਕੋਲ ਮਤਲਬ ਅਤੇ ਜਿਹੜੇ ਵੱਡੇ ਜਿਮੀਂਦਾਰ ਹੈ ਵੱਡੇ ਜਿਮੀਂਦਾਰ ਲੋਕ ਹੈਗੇ ਉਹਨਾਂ ਕੋਲ ਤਾਂ ਮਤਲਬ ਬਹੁਤ ਜ਼ਿਆਦਾ ਉਹ ਹੈਗੇ ਹੈ ਸੰਦ ਕਹਿ ਲਓ ਜਾਂ ਕੁਛ ਵੀ ਕਹਿ ਲਓ ਹੈ ਨਾ ਵੀ ਉਹ ਖੇ ਖੇਤੀਬਾੜੀ 'ਚ ਉਹ ਚੀਜ਼ਾਂ ਯੂਜ ਕਰਕੇ ਪਰਾਲੀ ਨੂੰ ਯੂਜ ਕਰ ਲੈਂਦੇ ਹੈ ਬਾਕੀ ਜਿਹੜੀ ਕੀ ਹੈ ਮਤਲਬ ਸਾਡੇ ਪੇਂਡੂ ਕਿਸਾਨ ਹੈਗੇ ਹੈ ਉਹਨਾਂ ਕੋਲ ਵਿਚਾਰਿਆਂ ਕੋਲ ਕੋਈ ਸਹੂਲਤ ਹੀ ਹੈ ਨਹੀਂ ਗੀ ਹੈ ਨਾ ਉਹ ਮਤਲਬ ਪਰਾਲੀ ਨੂੰ ਅੱਗ ਲਗਾਉਣ 'ਚ ਜ਼ਿਆਦਾ ਵਿਸ਼ਵਾਸ਼ ਕਰਦੇ ਹੈ ਹੋਰ ਉਹਨਾਂ ਕੋਲ ਕੋਈ ਸਿਸਟਮ ਹੈ ਹੀ ਨੀਗਾ ਮਤਲਬ ਉਹ ਪਰਾਣੇ ਪਰਾਲੀ ਨੂੰ ਯੂਜ ਕਰ ਸਕਣ ਕਿਸੇ ਹਿਸਾਬ ਨਾਲ ਵੀ ਹੈ ਨਾ ਅਤੇ ਮਤਲਬ ਸਰਕਾਰ ਵੈਸੇ ਤਾਂ ਟੈਮ ਟੈਮ 'ਤੇ ਉਹ ਕਰ ਰਹੀ ਹੈ ਪਰ ਕੀ ਹੈ ਮਤਲਬ ਪਰਾਲੀ ਦਾ ਕੋਈ ਹੱਲ ਹੀ ਨਹੀਂ ਨਿਕਲ ਰਿਹਾ ਉਦਯੋਗ ਵੀ ਕਿੰਨੇ ਖਰੀਦਣੇ ਪਰਾਲੀ ਨੂੰ ਹੈ ਨਾ ਕਿਉਂਕਿ ਉਹਨਾਂ ਕੋਲ ਇਹ ਵੀ ਤਾਂ ਸਿਸਟਮ ਸਾਡੇ ਹੁਣੇ ਇੱਧਰਲੇ ਇਲਾਕਿਆਂ 'ਚ ਦੇਖੋ ਤਾਂ ਪਰਾਲੀਆਂ ਦੇ ਢੇਰ ਲੱਗੇ ਪਏ ਲੋਕਾਂ ਦੇ ਖੇਤਾਂ 'ਚ